ਅੱਜ ਕੱਲ੍ਹ ਦੀਆ ਔਰਤਾਂ ਅਸੀਂ ਕਹਿ ਸਕਦੇ ਹਾਂ ਸਾਰੀਆਂ ਹੀ ਪੜ੍ਹੀਆਂ ਲਿਖੀਆਂ ਹਨ ਪਰ ਉਹਨਾਂ ਨੂੰ ਹਾਲੇ ਵੀ ਵੱਡੀਆਂ ਵੱਡੀਆਂ ਚੁਣੌਤੀਆਂ ਤੋਂ ਨਿਕਲਣਾ ਪੈਂਦਾ ਜਿੱਦਾਂ ਕਿ ਅਗਰ ਕੋਈ ਔਰਤ ਬਾਹਰ ਵੀ ਕੰਮ ਕਰਦੀ ਹੈ ਉਹਨੂੰ ਪਹਿਲਾਂ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਹੈ ਸਾਰਾ ਕੁਛ ਸੋਚਣਾ ਪੈਂਦਾ ਫਿਰ ਉਹ ਬਾਹਰ ਜਾਂਦੀ ਹੈ ਉੱਥੇ ਅਲੱਗ ਅਲੱਗ ਚੁਣੌਤੀਆਂ ਪਾਰ ਕਰਨੀਆਂ ਪੈਂਦੀਆਂ ਰੋਜ਼ ਦੀਆਂ ਤਾਂ ਮਤਲਬ ਅਸੀਂ ਅਗਰ ਕਹਿ ਸਕਦੇ ਹਾਂ ਕਿ ਅਗਰ ਔਰਤਾਂ ਪੜ੍ਹੀਆਂ ਲਿਖੀਆਂ ਹੈ ਪਰ ਉਹਨਾਂ ਦੀ ਚੁਣੌਤੀਆਂ ਹਾਲੇ ਵੀ ਖਤਮ ਨਹੀਂ ਹੋਈਆਂ ਉਹਨਾ ਨੂੰ ਨਵੀਂਆਂ ਨਵੀਆਂ ਚੀਜ਼ਾਂ ਮਿਲਦੀਆਂ ਰੋਜ਼ ਕਿ ਜਿਨ੍ਹਾਂ ਤੋਂ ਉਹਨਾਂ ਨੂੰ ਨਿਕਲਣਾ ਪੈਂਦਾ ਔਰ ਕਿੰਨੀਆਂ ਵੀ ਮੁਸ਼ਕਿਲਾਂ ਆਉਣ ਪਰ ਉਹ ਰੋਜ਼ ਇੱਕ ਮੁਸ਼ਕਿਲ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਹਾਲੇ ਵੀ ਔਰਤਾਂ ਉੱਦਾਂ ਆਪਣੀ ਜਗ੍ਹਾ ਨਹੀਂ ਬਣਾ ਪਾਈ ਜੇ ਅੱਜ ਕੱਲ੍ਹ ਦੇ ਆਦਮੀ ਆਪਣੀਆਂ ਜਗ੍ਹਾ ਬਣਾ ਕੇ ਰੱਖੀ ਹੈ ਔਰਤਾਂ ਨੂੰ ਬਸ ਦੋਨੋਂ ਪਾਸੇ ਪੂਰੇ ਧਿਆਨ ਨਾਲ ਚੱਲਣਾ ਪੈਂਦਾ